ਚਾਰ ਜੁਲਾਈ ਦੋ ਹਜ਼ਾਰ ਇੱਕ ਸੱਤ ਅਕਤੂਬਰ ਦੋ ਹਜ਼ਾਰ ਤਿੰਨ ਦਸ ਮਈ ਦੋ ਹਜ਼ਾਰ ਅਠਾਰਾਂ ਬਾਰਾਂ ਜਨਵਰੀ ਦੋ ਹਜ਼ਾਰ ਪੰਦਰਾਂ ਤਿੰਨ ਮਾਰਚ ਦੋ ਹਜ਼ਾਰ ਬਾਈ